ਸਾਡੇ ਦਿਨ ਦੀ ਸ਼ੁਰੂਆਤ ਸਕੂਲ ਵਿੱਚ ਆ ਕੇ ਗਾਉਣ ਗਾਉਣ ਤੋਂ ਆਰੰਭ ਹੁੰਦੀ ਹੈ ਇਸ ਵਿੱਚ ਅਸੀਂ ਸਵੇਰੇ ਆਉਂਦੇ ਸਾਰ ਹੀ ਪ੍ਰਾਰਥਨਾ ਜੋ ਕੀ ਇੱਕ ਧੁਨੀ ਵਿੱਚ ਗਾਈ ਜਾਂਦੀ ਹੈ ਉਸ ਤੋਂ ਮਗਰੋਂ ਥੋੜ੍ਹੇ ਟਾਈਮ ਬਾਅਦ ਸਾਡਾ ਰਾਸ਼ਟਰੀ ਗਾਣ ਗਾਇਆ ਜਾਂਦਾ ਹੈ ਇਹ ਵੀ ਇੱਕ ਧੁਨੀ ਲੈ ਸੁਰ ਵਿੱਚ ਗਾਇਆ ਜਾਂਦਾ ਹੈ ਇਸ ਕਰਕੇ ਸਕੂਲ ਵਿੱਚ ਜਾਂ ਅਸੀਂ ਕੋਈ ਵੀ ਕੰਮ ਕਰਦੇ ਹਾਂ ਇਸ ਦੀ ਸ਼ੁਰੂਆਤ ਗਾਉਣ ਦੇ ਨਾਲ ਹੀ ਹੁੰਦੀ ਹੈ